ਹਾਂ ਬਿਲਕੁਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਨੂੰ ਯੋਗਾ ਨੂੰ ਸ਼ੌਂਕ ਵਜੋਂ ਅਪਣਾਉਣ ਲਈ ਕਿਸ ਨੇ ਪ੍ਰੇਰਿਤ ਕੀਤਾ ਵੈਸੇ ਤਾਂ ਮੇਰੀ ਯੋਗਾ ਵਿੱਚ ਰੁਚੀ ਕਈ ਚੀਜ਼ਾਂ ਦੇ ਸੁਮੇਲ ਨਾਲ ਪੈਦਾ ਹੋਈ ਪਰ ਇੱਕ ਖ਼ਾਸ ਵਿਅਕਤੀ ਹੈ ਜਿਸ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਗੱਲ ਉਦੋਂ ਦੀ ਹੈ ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸੀ ਮੇਰੀ ਇੱਕ ਪ੍ਰੋਫੈਸਰ ਮੇਰਾ ਇਕ ਪ੍ਰੋਫੈਸਰ ਸਨ ਮੈਡਮ ਗੁਰਪ੍ਰੀਤ ਕੌਰ ਉਹ ਸਾਨੂੰ ਫਿਲੋਸਫੀ ਪੜ੍ਹਾਉਂਦੇ ਸਨ ਅਤੇ ਉਸ ਦਾ ਪੜ੍ਹਾਉਣ ਦਾ ਤਰੀਕਾ ਬਹੁਤ ਵੱਖਰਾ ਸੀ ਉਹ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦੇ ਸਨ ਸਗੋਂ ਜ਼ਿੰਦਗੀ ਦੇ ਅਸਲ ਮੁੱਦਿਆਂ ਬਾਰੇ ਵੀ ਗੱਲ ਕਰਦੇ ਸਨ ਉਹਨਾਂ ਦਾ ਵਿਸ਼ਵਾਸ ਸੀ ਕਿ ਸਿਰਫ਼ ਦਿਮਾਗ ਨੂੰ ਹੀ ਨਹੀਂ ਸਗੋਂ ਸਰੀਰ ਅਤੇ ਆਤਮਾ ਨੂੰ ਵੀ ਤੰਦਰੁਸਤ ਰੱਖਣਾ ਜ਼ਰੂਰੀ ਹੈ ਇੱਕ ਦਿਨ ਮੈਡਮ ਗੁਰਪ੍ਰੀਤ ਨੇ ਕਲਾਸ ਵਿੱਚ ਯੋਗਾ ਬਾਰੇ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਯੋਗਾ ਸਿਰਫ਼ ਕਸਰਤ ਹੀ ਨਹੀਂ ਸਗੋਂ ਇੱਕ ਜੀਵਨ ਸ਼ੈਲੀ ਹੈ ਉਹਨਾਂ ਨੇ ਯੋਗਾ ਦੇ ਫਰਮਾਉਂਦਿਆਂ ਬਾਰੇ ਦੱਸਿਆ ਜਿਵੇਂ ਕਿ ਤਣਾਅ ਘੱਟ ਕਰਨਾ ਮਨ ਨੂੰ ਸ਼ਾਂਤ ਰੱਖਣਾ ਅਤੇ ਸਰੀਰ ਨੂੰ ਲਚਕਦਾਰ ਬਣਾਉਣਾ ਉਹਨਾਂ ਨੇ ਇਹ ਵੀ ਦੱਸਿਆ ਕਿ ਯੋਗਾ ਨਾਲ ਅਸੀਂ ਆਪਣੇ ਅੰਦਰੂਨੀ ਆਪੇ ਨਾਲ ਜੁੜ ਸਕਦੇ ਹਾਂ ਮੈਡਮ ਗੁਰਪ੍ਰੀਤ ਜਦੋਂ ਯੋਗਾ ਬਾਰੇ ਗੱਲ ਕਰਦੇ ਸਨ ਤਾਂ ਉਹਨਾਂ ਨੂੰ ਚਿਹਰੇ ਤੇ ਇੱਕ ਵੱਖਰੀ ਹੀ ਚਮਕ ਸੀ ਉਹਨਾਂ ਦੀ ਗੱਲਬਾਤ ਵਿੱਚ ਇੱਕ ਅਜਿਹੀ ਸ਼ਾਂਤੀ ਅਤੇ ਅਸਥਿਰਤਾ ਸੀ ਜੋ ਮੈਨੂੰ ਬਹੁਤ ਪ੍ਰਭਾਵਿਤ ਕਰ ਰਹੀ ਗਈ ਮੈਨੂੰ ਲੱਗਿਆ ਕਿ ਜੇਕਰ ਯੋਗਾ ਇੰਨਾ ਹੀ ਸ਼ਕਤੀਸ਼ਾਲੀ ਹੈ ਤਾਂ ਮੈਨੂੰ ਵੀ ਇਸ ਨੂੰ ਅਜਮਾਉਣਾ ਚਾਹੀਦਾ ਹੈ ਮੈਡਮ ਗੁਰਪ੍ਰੀਤ ਨੇ ਸਾਨੂੰ ਯੋਗਾ ਦੀਆਂ ਕਲਾਸਾਂ ਬਾਰੇ ਦੱਸਿਆ ਜੋ ਉਹ ਆਪਣੇ ਘਰ ਵਿੱਚ ਲੈਂਦੇ ਸਨ ਮੈਂ ਉਹਨਾਂ ਦੀ ਕਲਾਸ ਵਿੱਚ ਸ਼ਾਮਲ ਹੋ ਗਈ ਸ਼ੁਰੂ ਵਿੱਚ ਮੈਨੂੰ ਕਈ ਮੁਸ਼ਕਲਾਂ ਆਈਆਂ ਪਰ ਮੈਡਮ ਗੁਰਪ੍ਰੀਤ ਨੇ ਮੈਨੂੰ ਮੇਰੀ ਬਹੁਤ ਮਦਦ ਕੀਤੀ ਉਸ ਨੇ ਮੈਨੂੰ ਹੌਲੀ ਹੌਲੀ ਸਿਖਾਇਆ ਅਤੇ ਮੈਨੂੰ ਹਮੇਸ਼ਾ ਪ੍ਰੇਰਿਤ ਕੀਤਾ ਮੈਡਮ ਗੁਰਪ੍ਰੀਤ ਨੇ ਮੈਨੂੰ ਤਾਂ ਸਿਰਫ਼ ਯੋਗਾ ਦੇ ਆਸਨ ਸਿਖਾਏ ਸਗੋਂ ਉਹਨਾਂ ਨੇ ਮੈਨੂੰ ਯੋਗਾ ਦੇ ਫਲਸਫੇ ਬਾਰੇ ਵੀ ਦੱਸਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਯੋਗਾ ਸਿਰਫ਼ ਸਰੀਰ ਨੂੰ ਹੀ ਨਹੀਂ ਸਗੋਂ ਮਨ ਅਤੇ ਆਤਮਾ ਨੂੰ ਵੀ ਸ਼ਾਂਤ ਕਰਦਾ ਹੈ ਉਹਨਾਂ ਨੇ ਮੈਨੂੰ ਵੀ ਇਹ ਵੀ ਦੱਸਿਆ ਕਿ ਯੋਗਾ ਸਾਨੂੰ ਆਪਣੇ ਨਾਲ ਜੋੜਨ ਅਤੇ ਅੰਦਰੂਨੀ ਸ਼ਾਂਤੀ ਨੂੰ ਲੱਭਣ ਦੀ ਮਦਦ ਕਰਦਾ ਹੈ ਮੈਡਮ ਗੁਰਪ੍ਰੀਤ ਸਿਰਫ਼ ਇੱਕ ਪ੍ਰੋਫੈਸਰ ਹੀ ਨਹੀਂ ਸਗੋਂ ਇੱਕ ਗੁਰੂ ਵੀ ਸਨ